ਪੰਜਾਬ ਵਿੱਚ ਬਹੁਤ ਪ੍ਰਮੁੱਖ ਖੇਡ ਸੰਸਥਾਵਾਂ ਜਾਂ ਫੈਡਰੇਸ਼ਨਾਂ ਹਨ ਜੋ ਰਾਜ ਵਿੱਚ ਵੱਖ ਵੱਖ ਖੇਡਾਂ ਨੂੰ ਸੰਚਾਲਿਤ ਅਤੇ ਉਤਸ਼ਾਹਿਤ ਕਰਦੀਆਂ ਹਨ ਜਿਵੇਂ ਕਿ ਪੰਜਾਬ ਕ੍ਰਿਕਟ ਐਸੋਸ਼ੀਏਸ਼ਨ ਹੈ ਜਿਹੜੀ ਕਿ ਕ੍ਰਿਕਟ ਸੰਬੰਧੀ ਜਿਹੜੇ ਜਿੰਨੇ ਵੀ ਮੈਚ ਨੇ ਟੂਰਨਾਮੈਂਟ ਨੇ ਉਹ ਕਰਵਾਉਂਦੀ ਹੈ ਅਤੇ ਸਟੂਡੈਂਟਸ ਨੂੰ ਅਤੇ ਜਿਹੜੇ ਪਲੇਅਰਜ਼ ਨੂੰ ਉਨ੍ਹਾਂ ਨੂੰ ਉਤਸ਼ਾਹਿਤ ਕਰਦੀ ਹੈ ਪੰਜਾਬ ਦੇ ਵਿੱਚ ਸਪੋਟਸ ਫੈਡਰੇਸ਼ਨ ਹੈਗੀ ਹੈ ਜਿਹੜੀ ਕਿ ਵੱਖ ਵੱਖ ਤਰ੍ਹਾਂ ਦੀ ਸਪੋਟਸ ਵੋਲੀਵੋਲ ਹੋਕੀ ਕ੍ਰਿਕਟ ਫੁੱਟਬੋਲ ਇਹ ਸਾਰੀਆਂ ਸਪੋਟਸ ਨੂੰ ਵੀ ਉਤਸ਼ਾਹਿਤ ਅਤੇ ਸੰਚਾਲਿਤ ਕਰਾਉਂਦੀਆਂ ਹਨ ਉਸ ਤੋਂ ਬਾਅਦ ਹਰ ਡਿਸਟਿਕ ਕੋਲ ਆਪਣੀ ਇੱਕ ਅਲੱਗ ਫੈਡਰੇਸ਼ਨ ਯਾ ਫਿਰ ਐਸੋਸੀਏਸ਼ਨ ਅਸੀਂ ਕਹਿ ਸਕਦੇ ਹਾਂ ਉਹ ਵੀ ਹੈ ਅਤੇ ਉਸ ਤੋਂ ਬਾਅਦ ਪੰਜਾਬ ਐਥਲੈਟਿਕਸ ਐਸੋਸੀਏਸ਼ਨ ਹੈ ਜਿਹੜੀ ਕਿ ਭੱਜ ਦੋੜ ਦੇ ਜਿਹੜੇ ਮੁਕਾਬਲੇ ਹੁੰਦੇ ਹਨ ਉਹਨਾਂ ਨੂੰ ਸੰਚਾਲਿਤ ਵੀ ਕਰਾਉਂਦੀ ਹੈ ਅਤੇ ਉਹਨਾਂ ਦੇ ਵਿੱਚ ਉਤਸ਼ਾਹ ਵੀ ਪੈਦਾ ਕਰਦੀ ਹੈ ਲੋਕਾਂ ਦੇ ਵਿੱਚ